ਸਮੇਂ ਦੇ ਨਾਲ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਬਦਲ ਗਈ ਹੈ ਜਿਵੇਂ ਕਿ ਲੋਕਾਂ ਬਾਹਰਲੇ ਲੋਕਾਂ ਨਾਲ ਆਪਣੀ ਪੰਜਾਬ ਦੇ ਲੋਕਾਂ ਦਾ ਰਹਿਣਾ ਸਹਿਣਾ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਕਿ ਬਾਹਰਲੇ ਲੋਕ ਪੰਜਾਬ ਵਿੱਚ ਆ ਕੇ ਰਹਿਣ ਲੱਗ ਪਏ ਪੜ੍ਹਨ ਲੱਗ ਪਏ ਅਤੇ ਇੱਥੇ ਹੀ ਕੰਮ ਕਰਨ ਲੱਗ ਪਏ ਅਤੇ ਉਹਨਾਂ ਨੂੰ ਜ਼ਿਆਦਾ ਕਰਕੇ ਹਿੰਦੀ ਜਾਂ ਇੰਗਲਿਸ਼ ਆਉਂਦੀ ਆ ਫਿਰ ਲੋਕ ਜਿਹੜੇ ਪੰਜਾਬ ਦੇ ਨੇ ਉਹ ਪੰਜਾਬੀ 'ਚ ਇੰਗਲਿਸ਼ ਔਰ ਹਿੰਦੀ ਮਿਕਸ ਕਰ ਲੈਂਦੇ ਆ ਇਸ ਨਾਲ ਪੰਜਾਬੀ ਜਿਹੜੀ ਕਿ ਉਹ ਬਦਲ ਹੋ ਜਾਂਦੀ ਹੈ ਪੰਜਾਬੀ ਭਾਸ਼ਾ ਬਦਲਦੀ ਜਾਂਦੀ ਆ ਅਤੇ ਬਾਹਰਲੇ ਜਿਹੜੇ ਲੋਕ ਇੱਥੇ ਆ ਕੇ ਜਿਹੜੇ ਕਿ ਪੰਜਾਬ ਵਿੱਚ ਤਿਉਹਾਰ ਪਹਿਲੇ ਨਹੀਂ ਮਨਾਏ ਜਾਂਦੇ ਸੀ ਸਿਰਫ ਆਪਣੇ ਸੱਭਿਆਚਾਰ ਰਿਲੇਟਿਡ ਹੀ ਮਨਾਏ ਜਾਂਦੇ ਤੇ ਪਰ ਜਦੋਂ ਦੇ ਬਾਹਰਲੇ ਲੋਕ ਇੱਥੇ ਆਉਂਦੇ ਨੇ ਉਹ ਆਪਣੇ ਤਿਉਹਾਰ ਇੱਥੇ ਹੀ ਮਨਾਉਂਦੇ ਨੇ ਤਾਂ ਲੋਕਾਂ ਉੱਪਰ ਉਹਨਾਂ ਦਾ ਬਹੁਤ ਪ੍ਰਭਾਵ ਪੈਂਦਾ ਅਤੇ ਕਈ ਲੋਕ ਤਾਂ ਉਹਨਾਂ ਨਾਲ ਮਿਲ ਕੇ ਉਹ ਵੀ ਤਿਉਹਾਰ ਮਨਾਉਣ ਲੱਗ ਪੈਂਦੇ ਨੇ ਇਸ ਕਾਰਨ ਵੀ ਉਹਨਾਂ ਦੀ ਜਿਹੜੀ ਆ ਭਾਸ਼ਾ ਉਹ ਚੇਂਜ ਹੋ ਜਾਂਦੀ ਹੈ ਅਤੇ ਹੋਰ ਵੀ ਇਸਦੇ ਬਹੁਤ ਹੀ ਕਾਰਨ ਹਨ